ਹੈਲੋ ਸਰ ਸਤਿ ਸ਼੍ਰੀ ਅਕਾਲ ਜੀ ਮੈਂ ਕੁਲਵਿੰਦਰ ਕੌਰ ਗੁਰਦਾਸਪੁਰ ਸ਼ਹਿਰ ਤੋਂ ਬੋਲ ਰਹੀ ਹਾਂ ਸਰ ਮੈਂ ਇੱਕ ਬੈੱਡ ਸ਼ੀਟ ਮੰਗਵਾਈ ਸੀ ਤੁਹਾਡੀ ਔਰ ਸਰ ਮੈਂ ਤਿੰਨ ਚਾਰ ਕਲਰ ਸੀ ਬੈੱਡ ਸ਼ੀਟ ਦੇ ਸਰ ਇਹਨਾਂ ਵਿੱਚੋਂ ਮੈਂ ਪਿੰਕ ਕਲਰ ਮੰਗਵਾਇਆ ਸੀ ਸਰ ਉਹ ਪਿੰਕ ਕਲਰ ਬਹੁਤ ਵਧੀਆ ਰਿਹਾ ਸਰ ਜਦ ਮੈਂ ਹਫਤੇ ਦਾ ਉਹਨਾਂ ਨੇ ਟਾਈਮ ਦਿੱਤਾ ਹੋਇਆ ਸੀ ਕਿ ਹਫਤੇ ਤੱਕ ਬੈੱਡ ਸ਼ੀਟ ਆ ਜਾਏਗੀ ਲੇਕਿਨ ਸਰ ਉਸ ਤੋਂ ਵੀ ਪਹਿਲਾਂ ਇੱਕ ਦਿਨ ਪਹਿਲਾਂ ਆ ਗਈ ਮੈਨੂੰ ਬਹੁਤ ਜ਼ਿਆਦਾ ਖੁਸ਼ੀ ਹੋਈ ਸਰ ਮੈਂ ਦੇਖ ਕਿ ਪਾਰਸਲ ਕਿ ਇੰਨੀ ਜਲਦੀ ਪਾਰਸਲ ਆ ਗਿਆ ਔਰ ਸਰ ਜਦ ਮੈਂ ਖੋਲ੍ਹਿਆ ਸਾਡੇ ਬੱਚੇ ਵੀ ਬਹੁਤ ਜ਼ਿਆਦਾ ਖੁਸ਼ ਹੋਏ ਵੀ ਇੰਨਾ ਇੰਨੀ ਵਧੀਆ ਬੈਡ ਸ਼ੀਟ ਦਾ ਪ੍ਰਿੰਟ ਸੀਗਾ ਬਹੁਤ ਵਧੀਆ ਬੈਡ ਸ਼ੀਟ ਸੀ ਔਰ ਫਿਰ ਸਰ ਜਦੋਂ ਸਾਡੇ ਘਰ ਅਗਲੇ ਦਿਨ ਗੈਸਟ ਆਏ ਫਿਰ ਮੈਂ ਫਿਰ ਬੈਡ ਸ਼ੀਟ ਵਿਛਾਈ ਸਰ ਗੈਸਟ ਨੇ ਵੀ ਬਹੁਤ ਜ਼ਿਆਦਾ ਪਸੰਦ ਕੀਤੀ ਬੈਡ ਸ਼ੀਟ ਇਸ ਕਰਕੇ ਸਰ ਜਿਹੜੇ ਗੈਸਟ ਸੀ ਨਾ ਉਹ ਵੀ ਕਹਿੰਦੇ ਸੀ ਸਾਨੂੰ ਇੱਕ ਬੈਡ ਸ਼ੀਟ ਮੰਗਵਾ ਕੇ ਦਿਓ ਹੋਰ ਮਤਲਬ ਬੈਡ ਸ਼ੀਟ ਮੰਗਵਾ ਕੇ ਦਿਓ ਔਰ ਮੈਂ ਕਿਹਾ ਠੀਕ ਹੈ ਜੀ ਤੁਹਾਨੂੰ ਹੋਰ ਬੈਡ ਸ਼ੀਟ ਮੰਗਵਾ ਦਿੰਦੇ ਹਾਂ ਫਿਰ ਜਦ ਸਰ ਗੈਸਟ ਚਲੇ ਗਏ ਫਿਰ ਮੈਂ ਬੈਡ ਸ਼ੀਟ ਨੂੰ ਵੋਸ਼ ਕੀਤਾ ਸਰ ਬਹੁਤ ਵਧੀਆ ਬੈਡ ਸ਼ੀਟ ਰਹੀ ਕਲਰ ਬਿਲਕੁਲ ਨਹੀਂ ਉਹਦਾ ਨਿਕਲਿਆ ਬਹੁਤ ਵਧੀਆ ਉਹਨਾਂ ਦਾ ਕਲਰ ਰਿਹਾ ਸਰ ਕੋਸ਼ਿਸ਼ ਇਹ ਹੈ ਕਿ ਅੱਗੇ ਤੋਂ ਹੋਰ ਜ਼ਿਆਦਾ ਮੰਗਵਾਵਾਂਗੇ ਪ੍ਰੋਡਕ ਤੁਹਾਡੇ ਓਕੇ ਸਰ ਬਾਏ ਥੈਂਕ